ਸਤਿ ਸ਼੍ਰੀ ਅਕਾਲ ਛੋਟੇ ਕਾਰੋਬਾਰ ਜਿਹੜੇ ਕਾਰੋਬਾਰ ਅਸੀਂ ਘਰ ਜਾਂ ਛੋਟੇ ਮੋਟੇ ਕੰਮਾਂ ਲਈ ਕਰਦੇ ਹਾਂ ਜਿਵੇਂ ਕਿ ਕੁਛ ਕੁ ਔਰਤਾਂ ਜਿੰਨਾ ਕੁਝ ਔਰਤਾਂ ਸਿਲਾਈ ਕਢਾਈ ਪਾਰਲਰ ਬੁਟੀਕ ਜਾਂ ਸੈਲੂਨ ਖੋਲ੍ਹ ਕੇ ਛੋਟੇ ਛੋਟੇ ਕੰਮ ਕਰਦੀਆਂ ਹਨ ਅਤੇ ਅਪ ਪੈਸੇ ਕਮਾਉਂਦੀਆਂ ਹਨ ਉਹਨਾਂ ਨੂੰ ਛੋਟੇ ਕਾਰੋਬਾਰ ਕਿਹਾ ਜਾਂਦਾ ਹੈ ਜਿਵੇਂ ਕੁਝ ਕੁ ਔਰਤਾਂ ਪੜ੍ਹੀਆਂ ਲਿਖੀਆਂ ਹੁੰਦੀਆਂ ਹਨ ਪਰ ਉਹਨਾਂ ਨੂੰ ਪੈਸਿਆਂ ਦੀ ਦਿੱਕਤ ਹੋਣ ਕਰਕੇ ਉਹ ਲੋਨ ਚੁੱਕ ਕੇ ਜਿਵੇਂ ਕਿਸੇ ਨੇ ਸਿਲਾਈ ਸੈਂਟਰ ਖੋਲ੍ਹ ਲਿਆ ਉਹ ਵੀ ਉਹਦਾ ਇੱਕ ਕਾਰੋਬਾਰ ਹੈ ਉਸ ਵਿੱਚ ਉਹ ਪੰਦਰ੍ਹਾਂ ਕੁ ਔਰਤਾਂ ਨੂੰ ਸਿਲਾਈ ਕਢਾਈ ਸਿਖਾਵੇਗੀ ਜਿਸ ਨਾਲ ਉਹਨੂੰ ਪੈਸਿਆਂ ਦੀ ਬਚਤ ਹੋਵੇਗੀ ਅਤੇ ਉਹ ਪੈਸੇ ਕਮਾਉਣ ਲੱਗ ਜਾਵੇਗੀ ਜਿਵੇਂ ਅਸੀਂ ਬਿਊਟੀ ਪਾਰਲਰ ਖੋਲ੍ਹ ਸਕਦੇ ਹਾਂ ਉਸ ਵਿੱਚ ਜਿਵੇਂ ਵੱਖ ਵੱਖ ਬਿਊਟੀ ਪਾਰਲਰ 'ਚ ਨੇਲ ਆਰਟ ਹੋ ਗਿਆ ਫੇਸ਼ੀਅਲ ਵਗੈਰਾ ਹੋ ਗਿਆ ਥਰੈਡਿਗ ਵਗੈਰਾ ਹੋ ਗਏ ਹੇਅਰ ਕਟਿੰਗ ਵਗੈਰਾ ਹੋ ਗਏ ਇਹਦੇ 'ਚ ਬਹੁਤ ਸਾਰੇ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ਜਿਵੇਂ ਅਸੀਂ ਛੋ ਜਿਹਨਾਂ ਕੋਲ ਪੈਸਿਆਂ ਦੀ ਦਿੱਕਤ ਹੁੰਦੀ ਹੈ ਉਹ ਆਪਣੇ ਛੋਟੇ ਮੋਟੇ ਕਾਰੋਬਾਰ ਚਲਾ ਕੇ ਆਪਣੇ ਘਰ ਦੀਆਂ ਘਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾ ਸਕਦੀਆਂ ਹਨ ਅੱਜ ਕੱਲ੍ਹ ਔਰਤਾਂ ਨੂੰ ਸਿਲਾਈ ਕਢਾਈ ਵਿੱਚ ਬਹੁਤ ਇੰਟਰਸਟ ਹੈ ਅਤੇ ਅੱਜ ਕੱਲ੍ਹ ਸਿਲਾਈ ਕਢਾਈ ਦਾ ਕੰਮ ਬਹੁਤ ਜ਼ਿਆਦਾ ਚੱਲਦਾ ਹੈ ਔਰਤਾਂ ਘਰ ਬੈਠ ਕੇ ਸੂਟ ਬਣਾਉਂਦੀਆਂ ਹਨ ਅਤੇ ਉਹਨਾਂ 'ਤੇ ਕਢਾਈ ਕਰਦੀਆਂ ਹਨ ਅਤੇ ਉਹ ਢੇਰ ਸਾਰੇ ਪੈਸੇ ਕਮਾਉਂਦੀਆਂ ਹਨ ਅਤੇ ਹੌਲੀ ਹੌਲੀ ਉਹਨਾਂ ਦਾ ਕਾਰੋਬਾਰ ਅੱਗੇ ਵਧਦਾ ਹੈ ਅਤੇ ਉਹਨਾਂ ਨੂੰ ਪੈਸਿਆਂ ਦੀ ਵ ਹੋਰ ਵੀ ਵੱਧ ਪੈਸੇ ਮਿਲਦੇ ਹਨ ਅਤੇ ਉਹ ਛੋਟੇ ਛੋਟੇ ਕਾਰੋਬਾਰ ਤੋਂ ਸਟੈਂਡ ਹੋ ਜਾਂਦੀਆਂ ਹਨ ਅਤੇ ਜਿਵੇਂ ਕਿ ਅੱਜ ਕੱਲ੍ਹ ਔਰਤਾਂ ਨੂੰ ਬਿਊਟੀ ਪਾਰਲਰ ਜਾਣਾ ਬਹੁਤ ਪਸੰਦ ਹੈ ਜਿਹਨਾਂ ਔਰਤਾਂ ਨੂੰ ਥੋੜ੍ਹਾ ਬਹੁਤਾ ਵੀ ਪਾਰਲਰ ਦਾ ਕੰਮ ਆਉਂਦਾ ਹੈ ਉਹ ਆਪਣਾ ਸੈਲੂਨ ਖੋਲ੍ਹ ਸਕਦੀਆਂ ਹਨ ਜਿਸ ਵਿੱਚ ਉਹ ਨੇਲ ਆਰਟ ਫੇਸ਼ੀਅਲ ਥਰੈਡਿੰਗ ਹੇਅਰ ਕਟਿੰਗ ਆਦਿ ਕੁਛ ਕਰਦੀਆਂ ਹਨ ਅੱਜ ਕੱਲ੍ਹ ਹੇਅਰ ਕਟਿੰਗ ਫੈਸ਼ਨ ਬਣ ਗਿਆ ਹੈ ਅਤੇ ਬਿਊਟੀ ਪਾਰਲਰ ਦੀ ਡਿਮਾਂਡ ਅੱਜ ਕੱਲ੍ਹ ਬਹੁਤ ਜ਼ਿਆਦਾ ਹੈ ਇਸ ਤਰ੍ਹਾਂ ਵੀ ਅਸੀਂ ਪੈਸਾ ਕਮਾ ਸਕਦੇ ਹਾਂ ਅਤੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾ ਸਕਦੇ ਹਾਂ ਧੰਨਵਾਦ